ਦਫ਼ਤਰਾਂ 'ਚ ਗੱਲ ਕੀਤੀ ਜਾਵੇ ਅਤੇ ਕਰਮਚਾਰੀ ਆਪਣਾ ਕੰਮ ਸਹੀ ਤਰ੍ਹਾਂ ਨਹੀਂ ਕਰਦੇ ਹੈ ਇੱਕ ਵਾਰ ਮੈਂ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣ ਵਾਸਤੇ ਗਈ ਸੀ ਪਹਿਲਾਂ ਤਾਂ ਉਹਨਾਂ ਨੇ ਮੇਰਾ ਆਧਾਰ ਕਾਰਡ ਅਪਡੇਟ ਕਰਨ ਵਾਸਤੇ ਕਦੇ ਕਹਿੰਦੇ ਇੱਕ ਬੈਂਚ 'ਤੇ ਮਤਲਬ ਕਿ ਜਾਓ ਕਦੇ ਕਹਿੰਦੇ ਦੂਸਰੇ ਕਾਊਂਟਰ 'ਤੇ ਜਾਓ ਕਦੇ ਕਹਿੰਦੇ ਤੀਸਰੇ ਕਾਊਂਟਰ 'ਤੇ ਜਾਓ ਕੋਈ ਅੱਛਾ ਰਿਸਪੋਂਸ ਨਹੀਂ ਦਿੰਦੇ ਸੀ ਚੱਲੋ ਜੇ ਅਗਰ ਬੜੇ ਮਗਰ ਪੈ ਕੇ ਉਹਨਾਂ ਦੇ ਅਗਰ ਉਹਨਾਂ ਨੇ ਅਪਡੇਟ ਕਰ ਵੀ ਦਿੱਤਾ ਪਰ ਉਹ ਮੇਰਾ ਰਿਜੈਕਟ ਹੋ ਗਿਆ ਉਹ ਹੈਂ ਉਸ ਤੋਂ ਬਾਅਦ ਮੈਂ ਫਿਰ ਗਈ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕੋਲੋਂ ਦੋ ਵਾਰ ਤਾਂ ਫੀਸ ਲੈਣ ਦੀ ਕੋਸ਼ਿਸ਼ ਕੀਤੀ ਹੈ ਜੋ ਨਹੀਂ ਬਣਦੀ ਸੀ ਉਹ ਵੀ ਉਹਨਾਂ ਨੇ ਫੀਸ ਮੈਨੂੰ ਲੈਣ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਇੱਕ ਭ੍ਰਿਸ਼ਟਾਚਾਰ ਹੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਜੋ ਸਾਡੇ ਦਫ਼ਤਰ ਵਿੱਚ ਕਰਮਚਾਰੀ ਬੈਠੇ ਵੇ ਹੈ ਨਾ ਕਿ ਉਹ ਸਾਡੀ ਸੇਵਾ ਵਾਸਤੇ ਨਹੀਂ ਬੈਠੇ ਦੇ ਹੈ ਉਹ ਸਿਰਫ਼ ਇੱਕ ਪੈਸਿਆਂ ਵਾਸਤੇ ਬੈਠੇ ਦੇ ਕਿ ਅਗਰ ਉਹਨਾਂ ਨੂੰ ਜਿਹੜਾ ਕੋਈ ਪੈਸੇ ਦੇ ਦਿੰਦਾ ਉਹਦਾ ਕੰਮ ਉਹ ਜਲਦੀ ਕਰ ਦਿੰਦੇ ਹੈ ਔਰ ਜਿਹੜਾ ਕੋਈ ਪੈਸੇ ਨਹੀਂ ਦਿੰਦਾ ਉਹਦਾ ਕੰਮ ਉਹ ਬਹੁਤ ਲਟਕਾ ਕੇ ਕਰਦੇ ਹੈ ਅਤੇ ਕੰਮ ਲਟਕਾ ਕਹਿੰਦੇ ਵੀ ਨਹੀਂ ਗੱਲ ਹੈ ਜੇ ਅਗਰ ਸਰਕਾਰ ਵੱਲੋਂ ਸਾਨੂੰ ਕੁਛ ਸੁਵਿਧਾ ਦਿੱਤੀ ਜਾਵੇ ਵੀ ਕਰਦੀ ਹੈ ਤਾਂ ਇਹਦੇ ਵਿੱਚ ਦਫ਼ਤਰ ਵਿੱਚ ਬੈਠਣ ਵਾਲੇ ਕਰਮਚਾਰੀਆਂ ਦਾ ਇਹ ਬਣਦਾ ਹੈ ਕਿ ਉਹ ਸਾਡਾ ਕੰਮ ਕਰਨ ਹੈਂ ਅਸੀਂ ਨਾਗਰਿਕ ਹਾਂ ਅਸੀਂ ਉੱਥੇ ਗਏ ਹਾਂ ਅਤੇ ਅਸੀਂ ਵੀ ਸਰਕਾਰ ਵੱਲੋਂ ਹੀ ਸਾਨੂੰ ਕਿਹਾ ਜਾਂਦਾ ਕਿ ਜੀ ਉਸ ਜਗ੍ਹਾ ਜਾਓ ਉਸ ਜਗ੍ਹਾ ਜਾਓ ਤੁਹਾਡਾ ਕੰਮ ਹੋ ਜਾਵੇਗਾ ਪਰ ਉਸ ਜਗ੍ਹਾ ਜਾ ਕੇ ਅਗਰ ਜਦੋਂ ਕੰਮ ਨਹੀਂ ਹੁੰਦਾ ਅਤੇ ਉਸ ਵੇਲੇ ਬਹੁਤ ਦੁੱਖ ਲੱਗਦਾ ਹੈ ਕਿ ਸਾਡਾ ਸਾਥ ਨਹੀਂ ਦਿੱਤਾ ਜਾਂਦਾ ਇਹੋ ਜਿਹੇ ਕਰਮਚਾਰੀ ਹੁੰਦੇ ਹੈ ਜਿਹੜੇ ਸਾਡਾ ਕੰਮ ਨਹੀਂ ਵੀ ਕਰਦੇ ਹੈ ਸਾਨੂੰ ਬਹੁਤ ਦੁੱਖ ਲੱਗਦਾ ਹੈ ਫਾਲਤੂ 'ਚ ਸਾਡੇ ਕੋਲੋਂ ਫੀਸਾਂ ਲੈਂਦੇ ਹੈ ਬਸ